ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਪਲੇਸਮੈਂਟ ਆਫੀਸ ਤੋਂ ਬੋਲਦੇ ਹੋ ਹਾਂਜੀ ਸਰ ਮੈਂ ਐਕਚੁਲੀ ਭਾਈ ਮਹਾ ਸਿੰਘ ਕੋਲਜ ਦੀ ਸਟੂਡੈਂਟ ਹਾਂ ਅਮਨਜੋਤ ਕੌਰ ਹਾਂਜੀ ਸਰ ਮੈਂ ਮਤਲਬ ਬੀ ਸੀ ਏ ਕੀਤੀ ਹੋਈ ਗ੍ਰੈਜੂਏਸ਼ਨ ਕੰਪਲੀਟ ਹੈ ਮੇਰੀ ਹਾਂਜੀ ਸਰ ਅਤੇ ਮਤਲਬ ਕਿ ਬੇਸਿਕ ਕੰਪਿਊਟਰ ਨੋਲੇਜ ਵਗੈਰਾ ਮਤਲਬ ਕਿਉਂਕਿ ਮੇਰੀ ਡਿਗਰੀ ਕੰਪਿਊਟਰ ਦੀ ਹੈ ਹੈਗੀ ਹੈ ਮੈਨੂੰ ਹਾਂਜੀ ਸਰ ਅਤੇ ਸਰ ਮੈਂ ਮਤਲਬ ਇਹ ਪੁੱਛਣਾ ਸੀਗਾ ਕਿ ਮੈਨੂੰ ਇੱਥੇ ਵਧੀਆ ਜੋਬ ਕਿਵੇਂ ਮਿਲ ਸਕਦੀ ਆਪਣੇ ਮੁਕਤਸਰ ਵਿੱਚ ਕੋਈ ਪਲੇਸਮੈਂਟ ਜੋਬ ਲਈ ਹੈ ਸਰ ਸੈਵਨਟੀ ਪਰਸੈਂਟ ਹਾਂਜੀ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਜੇ ਤੁਸੀਂ ਕਹਿੰਦੇ ਹੋ ਮੈਂ ਆਪਣਾ ਰਜੀਊਮ ਤੁਹਾਨੂੰ ਸੈਂਡ ਕਰ ਦਿੰਦੀ ਹਾਂ ਹਾਂਜੀ ਸਰ ਕੋਈ ਗੱਲ ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਠੀਕ ਹੈ ਸਰ ਸਰ ਫਿਰ ਮੈਂ ਤੁਹਾਨੂੰ ਆਪਣਾ ਰਜੀਊਮ ਵਗੈਰਾ ਸੈਂਡ ਕਰ ਦਿੰਦੀ ਹਾਂ ਅਤੇ ਸਰ ਕੋਈ ਅਦਰ ਡਾਕੂਮੈਂਟ ਹਾਂਜੀ ਅਤੇ ਸਰ ਟੈਂਨਥ ਪਲੱਸ ਟੂ ਦਾ ਡੀ ਐਮ ਸੀ ਠੀਕ ਹੈ ਸਰ ਅਤੇ ਆਧਾਰ ਕਾਰਡ ਵਗੈਰਾ ਮਤਲਬ ਉਹ ਵਾਲੇ ਡਾਕੂਮੈਂਟ ਠੀਕ ਹੈ ਸਰ ਹਾਂਜੀ ਸਰ ਥੈਂਕ ਯੂ ਸਰ ਠੀਕ ਹੈ ਸਰ